ਟੈਕਨੋਲਜੀ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਬਹੁਤ ਪ੍ਰਭਾਵਿਤ ਕੀਤਾ ਕਿਉਂਕਿ ਕਲਾਸ ਰੂਮਜ਼ ਦੇ ਵਿੱਚ ਜੋ ਉਹ ਆਪਣੇ ਇੰਟਰਨੈਟ ਦੇ ਥਰੂ ਪੜ੍ਹਾਇਆ ਜਾ ਰਿਹਾ ਸਮਾਟ ਕਲਾਸ ਦੇ ਥਰੂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਜਿਹਦੇ ਵੱਲੋਂ ਬੱਚਿਆਂ ਨੂੰ ਬਹੁਤ ਜ਼ਿਆਦਾ ਕੰਟੈਂਟ ਮਿਲ ਰਿਹਾ ਪੜ੍ਹਨ ਦੇ ਲਈ ਅਤੇ ਉਹ ਸਖ ਸੌਖੇ ਤਰੀਕੇ ਨਾਲ ਬੱਚਿਆਂ ਨੂੰ ਸਮਝ ਵੀ ਆ ਰਹੀ ਹੈ ਪੁਰਾਣੇ ਸਮੇਂ ਨਾਲੋਂ ਅੱਜ ਦੀ ਟੈਕਨੋਲਜੀ ਨੇ ਆ ਜੋ ਬੱਚਿਆਂ ਦੀ ਪੜ੍ਹਾਈ ਦਾ ਸਿੱਖਿਆ ਦਾ ਪੱਧਰ ਉੱਚਾ ਚੱਕਤਾ ਏ ਆ